ਹਾਂਜੀ ਮੈਨੂੰ ਬਹੁਤ ਸ਼ੌਕ ਹੈ ਰਸੋਈ ਦਾ ਕੰਮ ਕਰਨ ਦਾ ਕੁਕਿੰਗ ਕਰਨ ਦਾ ਜਿਸ ਤਰ੍ਹਾਂ ਸਾਡੇ ਘਰ ਪਾਰਟੀ ਸੀਗੀ ਬੱਚਿਆਂ ਦੀ ਬਰਥਡੇਅ ਪਾਰਟੀ ਸੀਗੀ ਉਹਦੇ ਵਿੱਚ ਅਸੀਂ ਖਾਣਾ ਬਣਾਇਆ ਮਿੱਠਾ ਵੀ ਬਣਾਇਆ ਜੋ ਵੀ ਬਣਾਇਆ ਆਪਣੇ ਘਰ ਵਿੱਚ ਮੇਰੇ ਨਾਲ ਮੰਮੀ ਸੀਗੇ ਉਹਨਾਂ ਨੇ ਹੈਲਪ ਕੀਤੀ ਆਪਾਂ ਦੋਵਾਂ ਨੇ ਰਲ ਮਿਲ ਕੇ ਖਾਣਾ ਬਣਾਇਆ ਅਸੀਂ ਜਿਸ ਤਰ੍ਹਾਂ ਅਸੀਂ ਹੁਣ ਰਾਤ ਨੂੰ ਅਸੀਂ ਸਵੇਰੇ ਮਟਰਾਂ ਦੀ ਸਬਜ਼ੀ ਬਣਾਉਣੀ ਸੀ ਰਾਤ ਨੂੰ ਹੀ ਮਟਰ ਕੱਢ ਕੇ ਰੱਖ ਲਏ ਸਬਜ਼ੀਆਂ ਕੱਟੀਆਂ ਰਾਤ ਨੂੰ ਹੀ ਕੱਟ ਲਈਆਂ ਫੇਰ ਗੰਢਾ ਵਗੈਰਾ ਸਭ ਕੁਛ ਕੱਟ ਕੇ ਰੱਖਿਆ ਸੀਗਾ ਸਵੇਰੇ ਅਸੀਂ ਉੱਠ ਕੇ ਮਸਾਲੇ ਬਣਾਏ ਸਾਰੀ ਸਬਜ਼ੀ ਦਾ ਇੱਕੋ ਵਾਰੀ ਮਸਾਲਾ ਤੜਕਾ ਜਿਹੜਾ ਸੀ ਉਹ ਅਸੀਂ ਤਿਆਰ ਕਰ ਲਿਆ ਫੇਰ ਅਸੀਂ ਉਹ ਸਾਰੀਆਂ ਸਬਜ਼ੀਆਂ ਦੇ ਵਿੱਚ ਪਾ ਕੇ ਥੋੜ੍ਹਾ ਥੋੜ੍ਹਾ ਅਸੀਂ ਸਬਜ਼ੀਆਂ ਤਿਆਰ ਕੀਤੀਆਂ ਆਪਣੀ ਰੋਟੀ ਬਣਾਈ ਸੋਹਣੀ ਰੋਟੀ ਬਣਾ ਕੇ ਤਿਆਰ ਕੀਤੀ ਫੇਰ ਜਿਸ ਤਰ੍ਹਾਂ ਅਸੀਂ ਹੁਣ ਮਿੱਠੇ ਵਿੱਚ ਕੜਾਹ ਬਣਾਉਣਾ ਸੀਗਾ ਅਸੀਂ ਕੜਾਹ ਵੀ ਬਣਾਇਆ ਪਾਣੀ ਪਹਿਲੋਂ ਹੀ ਗਰਮ ਕਰਕੇ ਰੱਖ ਲਿਆ ਜਦੋਂ ਅਸੀਂ ਰਵਾ ਭੁੰਨਿਆ ਉਹਨੂੰ ਭੁੰਨਣ ਤੋਂ ਬਾਅਦ ਵਿੱਚ ਇੱਕ ਅਸੀਂ ਖੰਡ ਦੀ ਚਾਹਣੀ ਜਿਹੜੀ ਉਹ ਗਰਮ ਪਾਣੀ 'ਚ ਪਾ ਕੇ ਬਣਾ ਕੇ ਇਹ ਵਿੱਚ ਪਾਈ ਅਤੇ ਬਹੁਤ ਸੋਹਣਾ ਸਾਡਾ ਕੜਾਹ ਵੀ ਬਣਿਆ ਅਸੀਂ ਤਿਆਰ ਕੀਤਾ ਇਸ ਤਰ੍ਹਾਂ ਅਸੀਂ ਆਪਣਾ ਜਿਹੜਾ ਰਸੋਈ ਦਾ ਕੰਮ ਆ ਸਾਨੂੰ ਇੱਕ ਸਾਡਾ ਇੱਕ ਸ਼ੌਕ ਵੀ ਹੈ ਅਤੇ ਸਾਨੂੰ ਮੈਨੂੰ ਬਹੁਤ ਚੰਗਾ ਲੱਗਦਾ ਰਸੋਈ ਦਾ ਕੰਮ ਕਰਨਾ ਅਤੇ ਇਸ ਕਰਕੇ ਮੈਂ ਇੱਦਾਂ ਸਾਰਾ ਕੰਮ ਜਿਹੜਾ ਰਸੋਈ ਦਾ ਖੁਦ ਵੀ ਕਰ ਲੈਂਦੀ ਹਾਂ ਅਤੇ ਹੈਲਪ ਵੀ ਲੈ ਲੈਂਦੀ ਹਾਂ